ਪ੍ਰੋਗਰਾਮਾਂ ਦੇ ਵਿੱਚ ਮੈਨੂੰ ਰੇਡੀਓ ਐੱਫ ਐੱਮ ਰੇਡੀਓ ਸੁਣਨਾ ਬਹੁਤ ਪਸੰਦ ਸੀ ਪਹਿਲਾਂ ਅਤੇ ਮੈਂ ਉਹ ਤੋਂ ਬਾਅਦ ਟੀਵੀ ਵੇਖਣਾ ਪਸੰਦ ਕਰਲਾ ਕਰਦਾ ਹਾਂ ਰੇਡੀਓ ਐੱਫ ਐੱਮ ਦੇ ਵਿੱਚ ਅੰਮ੍ਰਿਤਸਰ ਤੋਂ ਇੱਕ ਆਰ ਜੇ ਹੀ ਦਾ ਪ੍ਰੋਗਰਾਮ ਆਉਂਦਾ ਹੁੰਦਾ ਸੀ ਉਹ ਬਹੁਤ ਸੋਹਣੀਆਂ ਗੱਲਾਂ ਉਹਦੀਆਂ ਮੈਨੂੰ ਬਹੁਤ ਪਸੰਦ ਹੀ ਉਹ ਇੱਕ ਤਾਂ ਅੰਮ੍ਰਿਤਸਰ ਸ਼ਹਿਰ ਟਰੈਫਿਕ ਵਗੈਰਾ ਦੀ ਜਾਣਕਾਰੀ ਜਿਹੜੀ ਉਹ ਦਿੰਦੀ ਹੀ ਅਤੇ ਗਾਣੇ ਗੁਣੇ ਜਿਹੜੇ ਹੀ ਉਹ ਚਾਲੂ ਕਰਦੀ ਹੀ ਉਹ ਮੇਰੇ ਨਾਲ ਫੇਸਬੁੱਕ 'ਤੇ ਵੀ ਉਹਦਾ ਪੇਜ ਹੀ ਮੈਂ ਉਹ ਲਾਇਕ ਕੀਤਾ ਹੋਇਆ ਹੀ ਅਤੇ ਹੁਣ ਥੋੜ੍ਹਾਂ ਸਮਾਂ ਹੋਇਆ ਵਾ ਐੱਫ ਐੱਮ ਨਹੀਂ ਸੁਣੀਦਾ ਉਹ ਗੈਰਾ ਗੱਡੀ ਦੇ ਵਿੱਚ ਜਾਈਏ ਅਤੇ ਫਿਰ ਹੀ ਸੁਣੀਦਾ ਅਤੇ ਹੁਣ ਟੀਵੀ ਦੇ ਉੱਤੇ ਸੀ ਆਈਡੀ ਪ੍ਰੋਗਰਾਮ ਆਉਂਦਾ ਉਹ ਮੈਨੂੰ ਬਹੁਤ ਪਸੰਦ ਆ ਕਿਉਂਕਿ ਮੇਰੀ ਸ਼ੁਰੂ ਤੋਂ ਮਾਨਸਿਕਤਾ ਇੱਦਾਂ ਦੀ ਰਹੀ ਏ ਵੀ ਮੈਨੂੰ ਕ੍ਰਾਈਮ ਸਟੋਰੀਆਂ ਬਹੁਤ ਪਸੰਦ ਰਹੀਆਂ ਅਤੇ ਉਹ ਸਾਰਾ ਹੈ ਹੀ ਕ੍ਰਾਈਮ ਥਰੀਲਰ ਦੇ ਉੱਤੇ ਆ ਅਤੇ ਉਹ ਮੈਨੂੰ ਬਹੁਤ ਵਧੀਆ ਲੱਗਦਾ ਵਾ ਉਹਦੇ ਵਿੱਚ ਇਸ ਤੋਂ ਇਲਾਵਾ ਕੋਈ ਵੀ ਧਾਰਮਿਕ ਪ੍ਰੋਗਰਾਮ ਲੱਗਾ ਹੋਵੇ ਕੋਈ ਰਮਾਇਣ ਜਾਂ ਮਹਾਭਾਰਤ ਉਹ ਲੱਗਾ ਹੋਵੇ ਉਹ ਮੈਨੂੰ ਬਹੁਤ ਆਨੰਦ ਆਉਂਦਾ ਵਾ ਵੇਖਣ ਦਾ ਕਿਉਂਕਿ ਉਹ ਇੱਕ ਸਾਡੇ ਕਲਚਰ ਦੇ ਨਾਲ ਸਾਡੀ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਅਤੇ ਉਹ ਵੇਖਣ ਦਾ ਬਹੁਤ ਮਜ਼ਾ ਆਉਂਦਾ